ਮੈਂ ਆਪਣੀ ਵੈਸ਼ਨੋ ਦੇਵੀ ਯਾਤਰਾ ਬਾਰੇ ਜਾਣਕਾਰੀ ਦੇਣਾ ਚਾਹਵਾਂਗਾ ਕਿ ਵੈਸ਼ਨੋ ਦੇਵੀ ਮੈਂ ਆਪਣੇ ਪਰਿਵਾਰ ਨਾਲ ਪ੍ਰੋਗਰਾਮ ਬਣਾਇਆ ਸੀਗਾ ਅਸੀਂ ਸਾਰਿਆਂ ਨੇ ਮੱਥਾ ਟੇਕਣ ਜਾਈਏ ਅਤੇ ਮੌਸਮ ਅੱਛਾ ਸੀਗਾ ਅਤੇ ਅਸੀਂ ਆਪਣੀਆਂ ਕਾਰਾਂ ਦੇ ਥਰੂ ਪਹਿਲੇ ਉੱਥੇ ਜੰਮੂ ਤੋਂ ਗਾਹਾਂ ਉੱਥੇ ਪਹੁੰਚੇ ਕੱਟੜੇ ਪਹੁੰਚੇ ਅਤੇ ਫਿਰ ਅਸੀਂ ਉੱਥੋਂ ਅਸੀਂ ਆਪਣੀ ਜਿਹੜੀ ਚੜਾਈ ਦਾ ਪ੍ਰੋਗਰਾਮ ਪੈਦਲ ਦਾ ਸਾਰਿਆਂ ਨੇ ਮਾਇੰਡ ਬਣਾਇਆ ਅਤੇ ਅ ਚੜ੍ਹਾਈ ਸ਼ੁਰੂ ਕੀਤੀ ਸਾਰਿਆਂ ਨੇ ਅਸੀਂ ਪਹਿਲੋਂ ਅ ਚਰਨ ਪਾਦਗਾਰ ਪਹੁੰਚੇ ਅਤੇ ਉੱਥੇ ਦਰਸ਼ਨ ਕੀਤੇ ਫਿਰ ਅਸੀਂ ਅਗਾਂਹ ਵੱਧ ਕੇ ਆਪਣਾ ਅਧ ਕਵਾਰੀ ਪਹੁੰਚੇ ਅਤੇ ਉੱਥੇ ਅਸੀਂ ਕੁਛ ਦੇਰ ਲਈ ਆਪਣੀ ਥਕਾਵਟ ਲਾਈ ਉਸ ਤੋਂ ਬਾਅਦ ਅਸੀਂ ਆਪਣੀ ਪਰਚੀ ਕਟਵਾ ਕੇ ਅਤੇ ਅੱਗੇ ਯਾਤਰਾ ਵਾਸਤੇ ਉੱਪਰ ਚੱਲ ਪਏ ਅਤੇ ਅਸੀਂ ਉੱਥੇ ਫਿਰ ਭੈਰੋਂ ਬਾਬਾ ਜੀ ਦੇ ਵੀ ਉੱਥੇ ਦਰਸ਼ਨ ਕੀਤੇ ਚੜ੍ਹਾਈ ਕਰਕੇ ਉੱਥੇ ਫਸਿਲਟੀ ਸੀਗੀ ਰੋਪਵੇ ਦੀ ਲੇਕਿਨ ਸਾਡਾ ਵਿਚਾਰ ਸੀ ਕਿ ਅ ਅਸੀਂ ਆਪ ਪੈਦਲ ਹੀ ਚੜ੍ਹਾਈ ਚੜੀਏ ਤਾਂ ਕਿ ਸਾਨੂੰ ਜਿਹੜੀ ਯਾਤਰਾ ਦਾ ਫ਼ਲ ਪੂਰਾ ਮਿਲੇ ਜਿਹੜਾ ਇਹ ਮਾਤਾ ਦੇ ਦਰਸ਼ਨ ਕਰਨ ਆਏ ਹਾਂ ਭੈਰੋਂ ਬਾਬਾ ਦੇ ਮੱਥਾ ਟੇਕਣ ਅਤੇ ਅ ਅਸੀਂ ਸਾਰਿਆਂ ਨੇ ਇੱਕ ਦੂਸਰੇ ਦੀ ਮਾਤਾ ਦਾ ਨਾਂ ਲੈਂਦੇ ਲੈਂਦੇ ਇਸੀ ਇੱਥੇ ਚੜ੍ਹਾਈ ਨੂੰ ਪੂਰਾ ਕੀਤਾ ਅਤੇ ਉੱਪਰ ਜਾ ਕੇ ਅਸੀਂ ਬੜੇ ਸੁੰਦਰ ਦਰਸ਼ਨ ਕੀਤੇ ਜਿਹੜੇ ਕਿ ਪਹਾੜਾਂ ਦੇ ਅੰਦਰ ਜਿਹੜੇ ਗੁਫਾ ਬਣੀ ਹੋਈ ਹੈ ਮਾਤਾ ਜੀ ਦੀ ਏ ਪੂਰੇ ਆਰਾਮ ਨਾਲ ਸ਼ਾਂਤੀ ਨਾਲ ਸਾਨੂੰ ਦਰਸ਼ਨ ਕਰਾਏ ਗਏ ਅਸੀਂ ਆਪਣਾ ਮੱਥਾ ਟੇਕ ਕੇ ਆਪਣੀ ਪ੍ਰਾਰਥਨਾ ਕੀਤੀ ਅਤੇ ਇਹ ਬੜੀ ਸਾਡੀ ਯਾਦਗਾਰ ਯਾਤਰਾ ਸੀ ਔਰ ਮਾਤਾ ਦੇ ਬੜੇ ਸੁੰਦਰ ਦਰਸ਼ਨ ਸਾਨੂੰ ਹੋਏ